ਬਹੁਤ ਸਾਰੇ ਖਾਸ ਮੌਕੇ ਅਤੇ ਤਿਉਹਾਰ ਡਾਂਸ ਦੇ ਲਈ ਮਹੱਤਮਪੂਰਨ ਭੂਮਿਕਾ ਨਿਭਾਉਂਦੇ ਹਨ ਸਭ ਤੋਂ ਪਹਿਲਾਂ ਵਿਆਹ ਸ਼ਾਦੀ ਜਾਗੋ ਹੋ ਗਿਆ ਜਗਰਾਤਾ ਹੋ ਗਿਆ ਕੋਈ ਸ਼ਗਨ ਦਾ ਤਿਉਹਾਰ ਹੋ ਗਿਆ ਤਾਂ ਇਸ ਮੌਕੇ 'ਤੇ ਡਾਂਸ ਬਹੁਤ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜਿਵੇਂ ਕਿ ਸਾਉਣ ਦੇ ਮਹੀਨੇ ਵਿੱਚ ਤੀਜ ਦਾ ਤਿਉਹਾਰ ਬਹੁਤ ਵਧੀਆ ਨਾਲ ਮਨਾਇਆ ਜਾਂਦਾ ਹੈ ਜਿਵੇਂ ਕਿ ਪੰਜਾਬ ਦਾ ਫ਼ੇਮਸ ਬਹੁਤ ਜ਼ਿਆਦਾ ਗਿੱਧਾ ਹੈ ਗਿੱਧਾ ਪੰਜਾਬ ਦਾ ਲੋਕ ਨਾਚ ਹੈ ਜਿਵੇਂ ਕਿ ਲੋਕ ਇ ਇਸ ਵਿੱਚ ਬਹੁਤ ਜ਼ਿਆਦਾ ਡਾਂਸ ਵਗੈਰਾ ਕਰਦੇ ਹਨ ਅਤੇ ਲੋਕ ਜਗਰਾਤਾ ਜਗਰਾਤੇ ਦੇ ਵਿੱਚ ਵੀ ਡਾਂਸ ਦੀ ਬਹੁਤ ਜ਼ਿਆਦਾ ਭੂਮਿਕਾ ਨਿਭਾਈ ਜਾਂਦੀ ਹੈ ਕ ਕਿਸੇ ਦੇ ਘਰ ਵਿੱਚ ਕੀਰਤਨ ਹੋ ਗਿਆ ਅਤੇ ਕੀਰਤਨ ਦੇ ਵਿੱਚ ਵੀ ਬਹੁਤ ਜ਼ਿਆਦਾ ਜਗਰਾਤੇ ਡਾਂਸ ਦਾ ਬਹੁਤ ਮਹੱਤਵਪੂਰਨ ਹੈ ਅਤੇ ਜਿਵੇਂ ਕਿ ਬੱਚਿਆਂ ਦਾ ਡਾਂਸ ਕੰਪੀਟੀਸ਼ਨ ਹੋਵੇ ਤਾਂ ਅਸੀਂ ਉਹਨਾਂ ਨੂੰ ਵੀ ਡਾਂਸ ਸਿਖਾ ਸਕਦੇ ਹਾਂ ਅਤੇ ਬਹੁਤ ਤਰ੍ਹਾਂ ਦਾ ਕੰਮ ਕਰ ਸਕਦੇ ਹਾਂ ਇਸ ਲਈ ਅਸੀਂ ਅ ਕੋਈ ਵੀ ਤਿਉਹਾਰ ਜਾਂ ਇੱਦਾਂ ਦਾ ਕੋਈ ਵੀ ਸਾਨੂੰ ਮੋਕਾ ਮਿਲੇ ਤਾਂ ਉਸ ਨੂੰ ਛੱਡਣਾ ਨਹੀਂ ਚਾਹੀਦਾ ਡਾਂਸ ਦਾ ਪੂਰਾ ਮਹੱਤਵਪੂਰਨ ਭੂਮਿਕਾ ਨਿਭਾਉਣਾ ਚਾਹੀ